ਜੇਕਰ ਸਿਰ ਦਰਦ ਹੋਵੇ ਤਾਂ ਉਸ ਦੇ ਨੁਸਖੇ ਲਗਭਗ ਚਾਰ ਕਾਲੀਆਂ ਮਿਰਚਾਂ ਤਿੰਨ ਗ੍ਰਾਮ ਅਦਰਕ ਅਤੇ ਸੱਤ ਜਾਂ ਅੱਠ ਪੱਤੇ ਤੁਲਸੀ ਦੇ ਲਉ ਫਿਰ ਉਹਨਾਂ ਨੂੰ ਕੁੱਟ ਕੇ ਪਾਣੀ ਵਿੱਚ ਉਬਾਲ ਕੇ ਉਹਨਾਂ ਦੀ ਚਾਹ ਬਣਾ ਕੇ ਪੀ ਲਉ ਉਸ ਨਾਲ ਸਿਰ ਦਰਦ ਖਤਮ ਹੋ ਜਾਂਦਾ ਹੈ ਲਸਣ ਦੇ ਪੱਤਿਆਂ ਦਾ ਰਸ ਕੱਢ ਕੇ ਪੀਣ ਨਾਲ ਸਿਰ ਦਰਦ ਖਤਮ ਹੋ ਜਾਂਦਾ ਹੈ ਸਿਰ ਦਰਦ ਹੋਣ 'ਤੇ ਅਦਰਕ ਦੀ ਚਾਹ ਪੀਉ ਉਸ ਨਾਲ ਸਿਰ ਦਰਦ ਖਤਮ ਹੋ ਜਾਂਦਾ ਹੈ ਅਤੇ ਚੌਥਾ ਨੁਸਖਾ ਲੌਂਗ ਲੌਂਗਾਂ ਨੂੰ ਤਵੇ 'ਤੇ ਗਰਮ ਕਰਕੇ ਫਿਰ ਉਹਨਾਂ ਨੂੰ ਕੁੱਟ ਕੇ ਉਹਨਾਂ ਦਾ ਲੇਪ ਬਣਾ ਕੇ ਮੱਥੇ 'ਤੇ ਲਗਾਉਣ ਨਾਲ ਸਿਰ ਦਰਦ ਘੱਟਦਾ ਹੈ ਸਵੇਰੇ ਉੱਠ ਕੇ ਸੇਬ 'ਤੇ ਲੂਣ ਲਾ ਕੇ ਖਾਣ ਨਾਲ ਸਿਰ ਦਰਦ ਘੱਟਦਾ ਹੈ ਅਤੇ ਦਾਲਚੀਨੀ ਨੂੰ ਪਾਣੀ 'ਚ ਪਾ ਕੇ ਲੇਪ ਬਣਾ ਕੇ ਸਿਰ 'ਤੇ ਲਗਾਉਣ ਨਾਲ ਸਿਰ ਦਰਦ ਘੱਟਦਾ ਹੈ ਇਹ ਨੁਸਖੇ ਸਾਡੇ ਪਿੰਡ ਵਿੱਚ ਵਰਤੇ ਜਾਂਦੇ ਹਨ